ਸਾਡੇ ਇਲਾਕੇ ਵਿੱਚ ਆਮਦਨ ਦੇ ਕਈ ਸਰੋਤ ਮੌਜੂਦ ਹਨ ਜਿਸ ਤਰ੍ਹਾਂ ਭੇਡਾਂ ਪਾਲਣਾ ਪਸ਼ੂ ਪਾਲਣ ਡੇਰੀ ਫਾਰਮ ਆਦਿ ਕਿੱਤੇ ਕਰਕੇ ਲੋਕ ਕਾਫੀ ਆਮਦਨ ਕਮਾ ਸਕਦੇ ਹਨ ਪੇਂਡੂ ਖੇਤਰ ਹੋਣ ਕਰਕੇ ਇੱਥੋਂ ਦੇ ਲੋਕ ਲੋਕ ਜ਼ਿਆਦਾ ਖੇਤੀਬਾੜੀ 'ਤੇ ਨਿਰਭਰ ਹਨ ਇਸ ਲਈ ਖੇਤਾਂ ਤੋਂ ਵੀ ਕਾਫੀ ਆਮਦਨ ਇਕੱਠੀ ਹੋ ਸਕਦੀ ਹੈ ਰੁਜ਼ਗਾਰ ਪ੍ਰਾਪਤ ਕਰਨ ਲਈ ਲੋਕ ਪਸ਼ੂ ਪਾਲਣ ਕਰ ਸਕਦੇ ਹਨ ਡੇਰੀ ਫਾਰਮ ਵਿੱਚ ਕਾਫੀ ਮੁਨਾਫਾ ਕਮਾ ਸਕਦੇ ਹਨ